ਪੰਜਾਬ ਵਿੱਚ ਰਾਜ ਸਰਕਾਰ ਦੇ ਦੂਜੇ ਪੱਧਰਾਂ ਵਿੱਚ ਜਿਵੇਂ ਸਥਾਨਕ ਨਗਰ ਪਾਲਿਕਾ ਅੱਛੀ ਤਰ੍ਹਾਂ ਕੰਮ ਕਰ ਰਹੀ ਹੈ ਕਿਉਂਕਿ ਦੇਖੋ ਬਿਜਲੀ ਦੇ ਬਿੱਲ ਜਿੱਦਾਂ ਰਾਜ ਸਰਕਾਰ ਵੱਲੋਂ ਨਗਰ ਪਾਲਿਕਾ ਨਾਲ ਮਿਲ ਕੇ ਵਾਟਰ ਸਪਲਾਈ ਜਿੱਦਾਂ ਤੇ ਬਿਲਡਿੰਗਾਂ ਦੇ ਫੰਡ ਵੀ ਪਲੈਨਿੰਗ ਕਿੱਦਾਂ ਬਣਾਉਣੀ ਹੈ ਕਿੱਥੇ ਕੀ ਲੱਗੇਗਾ ਕਿੱਥੇ ਕੀ ਹੋਏਗਾ ਕਿੱਦਾਂ ਤੁਸੀਂ ਅੱਛੀ ਤਰਾਂ ਨਾਲ ਘਰਾਂ ਦੀ ਬਣਨ ਦੀ ਪਲੈਨਿੰਗ ਕਰਦੀ ਹੈ ਤੇ ਅੱਜ ਕੱਲ ਤੇ ਤੁਹਾਨੂੰ ਬਿਲ ਜਮਾਂ ਕਰਾਣ ਲਈ ਕੋਈ ਲਾਈਨਾਂ 'ਚ ਨੀ ਇੰਨਾਂ ਲੱਗਣਾ ਪੈਂਦਾ ਹੈ ਤੇ ਨਾਲੇ ਤੁਹਾਨੂੰ ਕੋਈ ਅੱਜ ਕੱਲ ਆਨਲਾਈਨ ਬੜਾ ਕੰਮ ਹੋ ਗਿਆ ਹੈ ਨਗਰ ਪਾਲਿਕਾ ਬਹੁਤ ਜਿਆਦਾ ਵਧੀਆ ਕੰਮ ਕਰ ਰਹੀ ਹੈ ਰਾਜ ਸਰਕਾਰ ਨਾਲ ਮਿਲ ਕੇ ਦੋਨੋਂ ਜਣੇ ਮਿਲ ਕੇ ਅੱਛਾ ਕੰਮ ਕਰਦੇ ਹਨ ਤੇ ਜਿਦਾਂ ਸੜਕਾਂ ਦੀ ਸਫਾਈ ਕਰਾਉਂਦੇ ਹਨ ਹੋਰ ਵੀ ਬੜੇ ਕੰਮ ਤੁਹਾਨੂੰ ਤੁਹਾਡੇ ਕਾਰਡ ਵਗੈਰਾ ਬਣਾਉਂਦੇ ਹਨ ਤੇ ਨਗਰ ਪਾਲਿਕਾ ਦੇ ਜੋਨ ਹੁੰਦੇ ਹਨ ਉਦੋਂ ਸਾਡੇ ਸਾਰੇ ਜਿਹੜੇ ਵੀ ਸਾਡੇ ਮਹੱਲੇ ਦੇ ਹੈਗੇ ਉਹ ਬੜਾ ਅੱਛਾ ਕੰਮ ਕਰਦੇ ਆ ਸਾਡੇ ਗਲੀ 'ਚ ਰੋਜ਼ ਝਾੜੂ ਵਗੈਰਾ ਲਗਵਾਉਂਦੇ ਹਨ ਤੇ ਅੱਛੀ ਤਰਾਂ ਲਾਈਟਾਂ ਸਟਰੀਟ ਲਾਈਟਾਂ ਲਗਵਾਂਦੇ ਹਨ ਸਾਰਾ ਕੁਝ ਅੱਛੀ ਤਰ੍ਹਾਂ ਚੱਲ ਰਿਹਾ ਹੈ ਬਾਕੀ ਇਹ ਇੱਕ ਅੱਛਾ ਬੰਦਾ ਹੋਣ ਦੇ ਨਾਲ ਨਗਰ ਪਾਲਿਕਾ ਦਾ ਜਿਹੜਾ ਕੰਮ ਹੈ ਉਹ ਆਪੇ ਹੀ ਅੱਛਾ ਹੋ ਜਾਂਦਾ ਹੈ ਤੇ ਇਸ ਕਰਕੇ ਸਾਰੀਆਂ ਸਰਕਾਰ ਦੋਨੋਂ ਧਿਰਾਂ ਮਿਲ ਕੇ ਅੱਛਾ ਕੰਮ ਕਰਦੀਆਂ ਹਨ ਲਾਈਨਾਂ ਵਿਚ ਨਹੀਂ ਲੱਗਣਾ ਪੈਂਦਾ ਤੁਹਾਨੂੰ ਆਨਲਾਈਨ ਸਾਰੇ ਬਿੱਲ ਆ ਜਾਂਦੇ ਹਨ ਤੇ ਤੁਹਾਨੂੰ ਅੱਗੇ ਵਕਣ ਧੱਕੇ ਵੀ ਨਹੀਂ ਖਾਣੇ ਪੈਂਦੇ ਅੱਜ ਕੱਲ ਬਹੁਤ ਜਿਆਦਾ ਉਹਨਾਂ ਨੇ ਸਿਸਟਮ ਅੱਛਾ ਕਰ ਦਿੱਤਾ ਹੋਇਆ ਹੈ ਇਸ ਕਰਕੇ ਅੱਜ ਕੱਲ ਬਹੁਤ ਵਧੀਆ ਸਿਸਟਮ ਹੋ ਗਿਆ ਹੈ ਧੰਨਵਾਦ